ਸਾਡੇ ਸਿੱਖ ਧਰਮ ਨਾਲ ਸੰਬੰਧਿਤ ਬਹੁਤ ਸਾਰੇ ਗੀਤ ਹਨ ਜਿਹਨਾਂ ਵਿੱਚੋਂ ਕਿ ਦਸਾਂ ਦਸਾਂ ਪਾਤਸ਼ਾਹੀਆ ਦਸਾਂ ਪਾਤਸ਼ਾਹੀਆਂ ਨਾਲ ਰਿਲੇਟਿਡ ਗੀਤ ਬਣਾਏ ਗਏ ਹਨ ਜਿਨ੍ਹਾਂ ਵਿੱਚੋਂ ਸਰਬੰਸਦਾਨੀਆਂ ਜੋ ਗੀਤ ਹੈ ਉਹ ਕੁਲਬੀਰ ਝਿੰਜਰ ਗਾਇਕ ਦੁਆਰਾ ਗਾਇਆ ਗਿਆ ਹੈ ਅਤੇ ਜਿਸ ਵਿੱਚ ਉਹਨਾਂ ਨੇ ਇਹ ਕਿਹਾ ਕਿ ਮਤਲਬ ਅੱਜ ਦੇ ਟਾਈਮ ਵਿੱਚ ਲੋਕ ਜੋ ਹਨ ਸ਼੍ਰੀ ਗੁਰੂ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਜੋ ਕੁਰਬਾਨੀ ਹੈ ਉਸਨੂੰ ਭੁੱਲ ਜਾ ਰਹੇ ਭੁੱਲੇ ਜਾ ਰਹੇ ਹਨ ਉਹਨਾਂ ਨੇ ਸਿੱਖ ਧਰਮ ਨੂੰ ਬਚਾਉਣ ਲਈ ਜਾਂ ਸਿੱਖ ਧਰਮ ਨੂੰ ਬਚਾਉਣ ਲਈ ਅਤੇ ਲੋਕਾਂ ਨੂੰ ਜ਼ੁਲਮ ਤੋਂ ਮੁਕਤ ਕਰਵਾਉਣ ਲਈ ਆਪਣੇ ਚਾਰ ਪੁੱਤਰਾਂ ਆਪਣੇ ਚਾਰ ਪੁੱਤਰਾਂ ਦੀ ਕੁਰਬਾਨੀ ਦਿੱਤੀ ਆਪਣੇ ਪੂਰੇ ਪਰਿਵਾਰ ਤੋਂ ਵਿਛੜੇ ਵਿਛੜ ਗਏ ਅਤੇ ਲੋਕਾਂ ਦੀ ਭਲਾਈ ਵਾਸਤੇ ਉਹਨਾਂ ਨੇ ਆਪਣਾ ਸਾਰਾ ਪਰਿਵਾਰ ਕੁਰਬਾਨ ਕਰ ਦਿੱਤਾ ਬਟ ਅੱਜ ਸਮੇਂ ਵਿੱਚ ਲੋਕ ਉਹਨਾਂ ਦੀ ਜੋ ਵੀ ਇਸ ਦਿਨ ਨੂੰ ਭੁੱਲ ਭੁੱਲਦੇ ਜਾ ਰਹੇ ਹਨ ਇਸ ਸ਼ਬਦ ਵਿੱਚ ਉਹਨਾਂ ਨੇ ਇਸ ਗੀਤ ਵਿੱਚ ਉਹਨਾਂ ਨੇ ਇਹ ਹੀ ਦੱਸਿਆ ਹੈ